ਜਿਵੇਂ ਕਿ ਸਾਡੇ ਇਤਿਹਾਸ ਵਿੱਚ ਚਮਕੌਰ ਸਾਹਿਬ ਦੀ ਲੜਾਈ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦਾ ਪਰਿਵਾਰ ਵਿਛੜ ਗਿਆ ਸੀ ਅਤੇ ਲੜਾਈਆਂ ਵਾਲੇ ਖੇਤਰਾਂ ਵਿੱਚ ਚਲੇ ਗਏ ਸੀ ਚਮਕੌਰ ਸਾਹਿਬ ਦੀ ਲੜਾਈ ਸਤਾਰਾਂ ਸੌ ਦੋ ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਅਤੇ ਵਜ਼ੀਰ ਖਾਂ ਵਿਚਕਾਰ ਹੋਈ ਸੀ ਇਸ ਲੜਾਈ ਵਿਚਕਾਰ ਸਾਡੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਜੁਝਾਰ ਸਿੰਘ ਜੋ ਕਿ ਸ਼ਹੀਦ ਹੋ ਚੁੱਕੇ ਸਨ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰ ਨੂੰ ਇਹਨਾਂ ਸਭ ਲੜਾਈਆਂ ਕਰਕੇ ਇਹਨਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਉਸ ਤੋਂ ਬਾਅਦ ਸਰਸਾ ਨਦੀ 'ਤੇ ਵਜੀਰ ਖਾਂ ਦੀਆਂ ਫੌਜਾਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 'ਤੇ ਪਿੱਠ ਪਿੱਛੇ ਵਾਰ ਕਰ ਦਿੱਤਾ ਅਤੇ ਉਹਨਾਂ ਦਾ ਪਰਿਵਾਰ ਸਰਸਾ ਨਦੀ ਦੇ ਕੋਲ ਖੇਰੂੰ ਖੇਰੂੰ ਹੋ ਗਿਆ ਅਤੇ ਉਸ ਤੋਂ ਬਾਅਦ ਮੁਕਤਸਰ ਵਿਖੇ ਜਾ ਕੇ ਉਹਨਾਂ ਦਾ ਪਰਿਵਾਰ ਇਕੱਠਾ ਹੋਇਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਤਾਰਾਂ ਸੌ ਪੰਜਵੀ ਇਸਵੀਂ ਵਿੱਚ ਆਖਰੀ ਲੜਾਈ ਖਿਦਰਾਣਾ ਦੀ ਲੜੀ ਅਤੇ ਉਸ ਲੜਾਈ ਵਿੱਚ ਜੋ ਚਾਲੀ ਮੁਕਤੇ ਅਨੰਦਪੁਰ ਦੀ ਲੜਾਈ ਵਿੱਚ ਉਹਨਾਂ ਦਾ ਸਾਥ ਛੱਡ ਚੁੱਕੇ ਸਨ ਉਹ ਉਸ ਲੜਾਈ ਵਿੱਚ ਸ਼ਹੀਦ ਹੋ ਗਏ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਚਿੱਠੀ ਪਾੜ ਕੇ ਉਹਨਾਂ ਨੂੰ ਮੁਕਤ ਕਰ ਦਿੱਤਾ ਅਤੇ ਉਸ ਤੋਂ ਬਾਅਦ ਉਸ ਤੋਂ ਇਲਾਵਾ ਸ਼ ਸਰਦਾਰ ਭਗਤ ਸਿੰਘ ਊਧਮ ਸਿੰਘ ਸ਼੍ਰੀ ਰਾਜਗੁਰੂ ਸੁਖਦੇਵ ਸੁਖਦੇਵ ਜਤਿਨ ਦਾਸ ਵਰਗੇ ਹੋਰ ਮਹਾਨ ਸ਼ਖਸੀਅਤਾਂ ਨੇ ਦੇਸ਼ ਦੀ ਆਜ਼ਾਦੀ ਲਈ ਬਹੁਤ ਲੜਾਈਆਂ ਲੜੀਆਂ ਅਤੇ ਵੱਖ ਵੱਖ ਖੇਤਰਾਂ ਵਿੱਚ ਚਲੇ ਗਏ ਅਤੇ ਆਪਣੇ ਪਰਿਵਾਰਾਂ ਤੋਂ ਵਿਛੜ ਗਏ